ਸਤਿ ਸ਼੍ਰੀ ਅਕਾਲ ਜੀ ਅਸੀਂ ਐਮੋਜੋਨ ਤੋਂ ਪੈਂਨ ਕਲਰ ਪੈਨਸਲਾਂ ਆਰਡਰ ਕੀਤੀਆਂ ਸੀ ਜੋ ਕਿ ਤੁਹਾਡਾ ਪ੍ਰੋਡਕਟ ਬਹੁਤ ਵਧੀਆ ਨਿਕਲਿਆ ਬਹੁਤ ਜ਼ਿਆਦਾ ਵਧੀਆ ਨਿਕਲਿਆ ਜੋ ਪੈਨਸਲਾਂ ਕਲਰ ਪੈਨਸਲਾਂ ਸੀ ਉਹ ਬਹੁਤ ਜ਼ਿਆਦਾ ਵਧੀਆ ਸੀ ਅਸੀਂ ਉਹਨਾਂ ਉਹ ਪੈਨਸਲਾਂ ਮਤਲਬ ਓਸ ਪੈਨਸਲਾਂ ਤੋਂ ਇਲਾਵਾ ਵੀ ਉਹਨਾਂ ਦੇ ਵਿੱਚ ਦੋ ਪੈਨਸਲਾਂ ਐਕਸਟਰਾ ਸੀ ਮਤਲਬ ਕਿ ਅਸੀਂ ਅੱਜ ਕੱਲ੍ਹ ਜਿਹੜਾ ਆਰਡਰ ਕਰਦੇ ਹਾਂ ਟਾਈਮ ਸਿਰ ਨਹੀਂ ਪਹੁੰਚਦਾ ਪਰ ਤੁਹਾਡਾ ਤੁਹਾਡਾ ਬਹੁਤ ਟਾਈਮ 'ਤੇ ਪਹੁੰਚਿਆ ਪਰ ਹਾਂ ਅਸੀਂ ਅੱਗੋਂ ਤੋਂ ਵੀ ਤੁਹਾਡੇ ਨਾਲ ਜੁੜੇ ਰਹਾਂਗੇ ਤੁਹਾਡਾ ਪ੍ਰੋਡਕਟ ਹੋਰ ਚੀਜ਼ਾਂ ਵੀ ਆਰਡਰ ਕਰਾਂਗੇ ਮਤਲਬ ਕਿ ਅਸੀਂ ਬਹੁਤ ਟਾਈਮ ਤੋਂ ਹੋਰ ਜਗ੍ਹਾ 'ਤੇ ਵੀ ਪ੍ਰੋਡਕਟ ਆਰਡਰ ਕਰਦੇ ਹਾਂ ਪਰ ਉਹ ਚੀਜ਼ ਟਾਈਮ 'ਤੇ ਨਹੀਂ ਪਹੁੰਚਦੀ ਪਰ ਤੁਹਾਡਾ ਪ੍ਰੋਡਕਟ ਬਹੁਤ ਟਾਈਮ 'ਤੇ ਪਹੁੰਚਿਆ ਹਾਂ ਬਟ ਪੈਨਸਲਾਂ ਵੀ ਬਹੁਤ ਜ਼ਿਆਦਾ ਵਧੀਆ ਸੀ ਕਲਰ ਉਹਨਾਂ ਦਾ ਕਲਰ ਵੀ ਇੰਨੇ ਡਾਰਕ ਸੀ ਬਹੁਤ ਜ਼ਿਆਦਾ ਵਧੀਆ ਸੀਗਾ ਔਨਲਾਈਨ ਵੈਸੇ ਆਰਡਰ ਕਰਦੇ ਹਾਂ ਪਰ ਇਹ ਆਰਡਰ ਬਹੁਤ ਜ਼ਿਆਦਾ ਵਧੀਆ ਲੱਗਿਆ ਸਾਨੂੰ ਤੁਹਾਡੇ ਨਾਲ ਅਸੀਂ ਆਰਡਰ ਹੁਣ ਵੀ ਅੱਗੇ ਅੱਗੇ ਤੋਂ ਤੁਹਾਡੇ ਨਾਲ ਆਰਡਰ ਕਰਦੇ ਰਹਾਂਗੇ ਹੋਰ ਚੀਜ਼ਾਂ ਜਿਵੇਂ ਕਿ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਨਹੀਂ ਮਿਲਦੀਆਂ ਹੋਰ ਜਗ੍ਹਾ ਤੋਂ ਪਰ ਤੁਹਾਡੇ ਇਸ ਐਪ 'ਤੇ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਮਿਲਦੀਆਂ ਨੇ ਪੈਨਸਲਾਂ ਅਸੀਂ ਆਰਡਰ ਕੀਤੀਆਂ ਸੀ ਪਰ ਪੈਨਸਲਾਂ ਸਾਨੂੰ ਬਹੁਤ ਵਧੀਆ ਨਿਕਲਿਆ ਸਾਡੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਵਧੀਆ ਮਿਲਣ ਨਿਕਲੀਆਂ ਉਹ ਕਹਿੰਦੇ ਮੰਮਾ ਬਹੁਤ ਜ਼ਿਆਦਾ ਵਧੀਆ ਪੈਨਸਲਾਂ ਤੁਹਾਡੀਆਂ ਜੋ ਤੁਸੀਂ ਆਰਡਰ ਕੀਤ ਅਸੀਂ ਤੁਹਾਡੇ ਤੋਂ ਆਰਡਰ ਕੀਤੀਆਂ ਸੀ ਥੈਂਕ ਯੂ